ਚਾਰ ਦਸ ਉੱਨੀ ਸੌ ਅਠਾਨਵੇਂ ਬਾਰਾਂ ਬਾਰਾਂ ਦੋ ਹਜ਼ਾਰ ਬਾਰਾਂ ਗਿਆਰਾਂ ਅੱਠ ਦੋ ਹਜ਼ਾਰ ਵੀਹ ਬਾਰਾਂ ਤਿੰਨ ਦੋ ਹਜ਼ਾਰ ਅਠਾਰਾਂ ਇਕ ਦਸ ਦੋ ਹਜ਼ਾਰ ਅਠਾਰਾਂ